ਮੈਂ ਕੁਛ ਦਿਨ ਪਹਿਲਾਂ ਆਪਣੇ ਪਾਣੀ ਦੇ ਬਿਲ ਦੀ ਰਕਮ ਅਦਾ ਕੀਤੀ ਜਿਸ ਦੇ ਵਿੱਚ ਕਿ ਮੈਨੂੰ ਬਹੁਤ ਸਾਰੀਆਂ ਗਲਤੀਆਂ ਦਿਖਾਈ ਦੇ ਰਹੀਆਂ ਹਨ ਇਸ ਦੇ ਲਈ ਮੈਂ ਅੱਗੇ ਦੀ ਜਾਂਚ ਕਰਵਾਉਣਾ ਚਾਹੁੰਦਾ ਹਾਂ ਮੈਂ ਇਸ ਦੇ ਲਈ ਪੁੱਛ ਗਿੱਛ ਕਰਨ ਦੇ ਲਈ ਜਨ ਅਥੋਰਿਟੀ ਦੇ ਗ੍ਰਾਹਕ ਸੇਵਾ ਵਿਭਾਗ ਨਾਲ ਸੰਪਰਕ ਕਰਨਾ ਚਾਹੁੰਦਾ ਹਾਂ ਕੀ ਤੁਸੀਂ ਇਸ ਦੇ ਵਿੱਚ ਮੇਰੀ ਮਦਦ ਕਰ ਸਕਦੇ ਹੋ ਕਿ ਮੈਂ ਜਲ ਅਥੋਰਟੀ ਦੇ ਸੇਵਾ ਵਿਭਾਗ ਨਾਲ ਕਿਵੇਂ ਸੰਪਰਕ ਕਰਨਾ ਚਾਹੁੰਦਾ ਹਾਂ ਮੇਰੇ ਦਿੱਤੀ ਹੋਏ ਰਕਮ ਦੇ ਅਨੁਸਾਰ ਇਸ ਵਿੱਚ ਖਾਤਾ ਨੰਬਰ ਅਤੇ ਬਿਲਿੰਗ ਚੱਕਰ ਵਿੱਚ ਬਹੁਤ ਸਾਰੀਆਂ ਗਲਤੀਆਂ ਦਿਖਾਈ ਦੇ ਰਹੀਆਂ ਹਨ ਜਿਸ ਕਰਕੇ ਮੈਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਨ੍ਹਾਂ ਮੁਸ਼ਕਿਲਾਂ ਤੋਂ ਬਚਣ ਦੇ ਲਈ ਤੁਸੀਂ ਮੇਰੀ ਕਿਵੇਂ ਮਦਦ ਕਰ ਸਕਦੇ ਹੋ